ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਸਾਡੇ ਪੰਜਾਬ ਵਿੱਚ ਵੈਸੇ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਕਿਉਂਕਿ ਸਾਡੇ ਪੰਜਾਬ ਵਿੱਚ ਵੱਖ ਵੱਖ ਧਰਮਾਂ ਅਤੇ ਜਾਤੀਆਂ ਦੇ ਲੋਕ ਰਹਿੰਦੇ ਹਨ ਇਸ ਲਈ ਸਾਰੇ ਆਪਣੀ ਆਪਣੀ ਵੱਖਰੀ ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਮੈਂ ਤੁਹਾਨੂੰ ਪੰਜਾਬੀ ਭਾਸ਼ਾ ਦੇ ਇਤਿਹਾਸ ਬਾਰੇ ਕੁਝ ਥੋੜ੍ਹਾ ਜਿਹਾ ਦੱਸਣਾ ਚਾਹਾਂਗੀ ਪੰਜਾਬੀ ਭਾਸ਼ਾ ਦਾ ਵਿਕਾਸ ਪ੍ਰਕਿਰਤਿਕ ਭਾਸ਼ਾਵਾਂ ਨਾਲ ਹੋਇਆ ਸੀ ਬਾਅਦ ਵਿੱਚ ਅਪਭ੍ਰੰਸ਼ ਭਟਕਣ ਵਾਲਾ ਜਾਂ ਗੈਰ ਵਿਗਿਆਨਿਕ ਕਰਨ ਹੋ ਗਿਆ ਸੀ ਛੇ ਸੌ ਈਸਵੀ ਪੂਰਬ ਤੋਂ ਸੰਸਕ੍ਰਿਤ ਨੂੰ ਮਿਆਰੀ ਸਾਹਿਤਿਕ ਅਤੇ ਪ੍ਰਬੰਧਕੀ ਭਾਸ਼ਾ ਵਿੱਚ ਵਿਕਸਿਤ ਵਿਕਸਿਤ ਕੀਤਾ ਗਿਆ ਸੀ ਅਤੇ ਪ੍ਰਕਿਰਤਿਕ ਭਾਸ਼ਾਵਾਂ ਵੱਖ ਵੱਖ ਖੇਤਰਾਂ ਵਿੱਚ ਖੇਤਰੀ ਭਾਸ਼ਾ ਵਿਕਸਿਤ ਹੋਈਆਂ ਹਨ ਭਾਰਤ ਦੇ ਹਿੱਸੇ ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਸਮੂਹਿਕ ਤੌਰ 'ਤੇ ਪ੍ਰਕਿਰਤਿਕ ਭਾਸ਼ਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ ਜੋ ਉੱਤਰੀ ਅਤੇ ਉੱਤਰ ਪੱਛਮੀ ਭਾਰਤ ਵਿੱਚ ਬੋਲੀਆਂ ਜਾਂਦੀਆਂ ਸਨ ਪੰਜਾਬੀ ਸੱਤਵੀਂ ਸਦੀ ਈਸਵੀ ਵਿੱਚ ਇੱਕ ਅਪਭ੍ਰੰਸ਼ ਦੇ ਰੂਪ ਵਿੱਚ ਉਭਰੀ ਜੋ ਕਿ ਪ੍ਰਕਿਰਤਿਕ ਪ੍ਰਕਿਰਤਿਕ ਭਾਸ਼ਾ ਦਾ ਇੱਕ ਵਿਗੜਿਆ ਹੋਇਆ ਰੂਪ ਸੀ ਅਤੇ ਪੰਜਾਬੀ ਦਸਵੀਂ ਸਦੀ ਤੱਕ ਸਥਿਰ ਹੋ ਗਿਆ ਪੰਜਾਬੀ ਵਿੱਚ ਸਭ ਤੋਂ ਪੁਰਾਣੀਆਂ ਲਿਖਤਾਂ ਨੌਵੀਂ ਤੋਂ ਚੌਦਵੀਂ ਸਦੀ ਤੱਕ ਨਾਥ ਯੋਗੀ ਯੁਗ ਨਾਲ ਸੰਬੰਧਿਤ ਹਨ ਦਸਵੀਂ ਅਤੇ ਸੋਲਵੀਂ ਸਦੀ ਦੇ ਵਿਚਕਾਰ ਪੰਜਾਬੀ ਦੀ ਪੂਰਵ ਅਵਸਥਾ ਨੂੰ ਪੁਰਾਣੀ ਪੰਜਾਬੀ ਕਿਹਾ ਜਾਂਦਾ ਹੈ ਅਤੇ ਬਾਅਦ ਵਿੱਚ ਸੋਲਵੀਂ ਅਤੇ ਉਨੀਵੀਂ ਸਦੀ ਦੇ ਵਿਚਕਾਰ ਦੇ ਪੜਾਅ ਨੂੰ ਮੱਧਕਾਲੀ ਪੰਜਾਬੀ ਕਿਹਾ ਜਾਂਦਾ ਹੈ ਆਧੁਨਿਕ ਪੰਜਾਬੀ ਉਨੀਵੀਂ ਸਦੀ ਵਿੱਚ ਮੱਧਕਾਲੀ ਪੰਜਾਬੀ ਸਟੇਜ ਤੋਂ ਉਭਰ ਕੇ ਸਾਹਮਣੇ ਆਈ ਹੈ ਆਧੁਨਿਕ ਪੰਜਾਬੀ ਦੀਆਂ ਦੋ ਮੁੱਖ ਕਿਸਮਾਂ ਹਨ ਜਿਵੇਂ ਪੱਛਮੀ ਲਹਿੰਦਾ ਪੰਜਾਬ ਅਤੇ ਪੂਰਵੀ ਚੜ੍ਹਦਾ ਪੰਜਾਬ ਜਿਹਨਾਂ ਦੀਆਂ ਬਹੁਤ ਸਾਰੀਆਂ ਉਪਭਾਸ਼ਾਵਾਂ ਅਤੇ ਰੂਪ ਹਨ ਜੋ ਕਿ ਕੁੱਲ ਮਿਲਾ ਕੇ ਇਕ ਸੌ ਪੰਜਾਹ ਮਿਲੀਅਨ ਤੋਂ ਵੱਧ ਲੋਕ ਬੋਲਦੇ ਹਨ ਮਾਝੀ ਉਪਭਾਸ਼ਾ ਜੋ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਸਿੱਖਿਆ ਅਤੇ ਮਾਸ ਮੀਡੀਆ ਲਈ ਮਿਆਰੀ ਭਾਸ਼ਾ ਪੰਜਾਬੀ ਵਜੋਂ ਅਪਣਾਈ ਗਈ ਹੈ ਭਾਰਤ ਵਿੱਚ ਦਫਤਰਾਂ ਸਕੂਲਾਂ ਅਤੇ ਮੀਡੀਆ ਵਿੱਚ ਪੰਜਾਬੀ ਨੂੰ ਗੁਰਮੁਖੀ ਵਿੱਚ ਲਿਖਿਆ ਗਿਆ ਹੈ ਪਾਕਿਸਤਾਨ ਵਿੱਚ ਪੰਜਾਬੀ ਆਮ ਤੌਰ 'ਤੇ ਸ਼ਾਹਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਹੌਲੀ ਹੌਲੀ ਲੋਕਾਂ ਨੇ ਇੱਕ ਦੂਜੇ ਨਾਲ ਮਿਲਣਾ ਜੁਲਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੂੰ ਆਪਣੀਆਂ ਗੱਲਾਂ ਇੱਕ ਤੋਂ ਦੂਜੇ ਤੱਕ ਪਹੁੰਚਾਉਣ ਲਈ ਸਿਰਫ ਇੱਕ ਭਾਸ਼ਾ ਹੀ ਉਹਨਾਂ ਦਾ ਜ਼ਰੀਆ ਸੀ ਜਿਸ ਨਾਲ ਉਹ ਆਪਣੇ ਕੁਝ ਸ਼ਬਦਾਂ ਨੂੰ ਦੂਜੇ ਲੋਕਾਂ ਅੱਗੇ ਪੇਸ਼ ਕਰ ਸਕਣ ਪੰਜਾਬੀ ਦੀਆਂ ਬਹੁਤ ਸਾਰੀਆਂ ਉਪਭਾਸ਼ਾਵਾਂ ਹਨ ਜੋ ਵੱਖ ਵੱਖ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ ਜਿਵੇਂ ਮੁੱਖ ਤੌਰ 'ਤੇ ਮਾਝੀ ਮਲਵਈ ਦੁਆਬੀ ਪੁਆਧੀ ਇਹ ਪੰਜਾਬੀ ਦੀਆਂ ਮੁੱਖ ਉਪਭਾਸ਼ਾਵਾਂ ਹਨ ਪੰਜਾਬ ਜਿਵੇਂ ਮਾਝੀ ਜੋ ਕਿ ਟਕਸਾਲੀ ਰੂਪ ਵਿੱਚ ਵਰਤੀ ਜਾਂਦੀ ਹੈ ਇਸ ਨੂੰ ਅਸੀਂ ਜਿਵੇਂ ਸਕੂਲਾਂ ਵਿੱਚ ਬੁਕਸ ਕਾਪੀਆਂ ਕਿਤਾਬਾਂ ਜਿਵੇਂ ਆਹ ਵੀ ਪੰਜਾਬੀ ਦੀ ਮਾਝੀ ਭਾਸ਼ਾਵਾਂ ਵਿੱਚ ਬੋਲੀਆਂ ਜਾਂਦੀਆਂ ਹਨ ਮਾਝੀ ਭਾਸ਼ਾ ਨੂੰ ਦਫਤਰੀ ਭਾਸ਼ਾ ਵੀ ਕਿਹਾ ਜਾਂਦਾ ਹੈ ਧੰਨਵਾਦ